ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਭਾਈ ਰਿਸਰਚਰ ਹਾਂ ਅਤੇ ਮੈਂ ਜਾਣਨਾ ਚਾਹੁੰਦਾ ਕਿ ਪੰਜਾਬ ਵਿੱਚ ਜਿਹੜੀ ਪੰਜਾਬ ਤੁਹਾਡਾ ਹੈ ਨਾ ਡਿਸਟ੍ਰਿਕਟ ਉਹਦਾ ਸਾਡੇ ਇੰਡੀਆ ਦੇਸ਼ ਵਿੱਚ ਇਕੋਨਮੀ ਦਾ ਕੀ ਰੋਲ ਹੈਗਾ

ਠੀਕ ਆ ਭਾਈ ਠੀਕ ਆ ਭਾਈ ਠੀਕ ਆ ਭਾਈ ਓਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ